ਲੁਧਿਆਣਾ ਜਲੰਧਰ ਅੰਮ੍ਰਿਤਸਰ ਖੰਨਾ ਅਬੋਹਰ ਮੋਗਾ ਫਤਿਹਗੜ੍ਹ ਸਾਹਿਬ ਮੋਹਾਲੀ ਜਗਰਾਉਂ

ਜਗਰਾਉਂ ਮਲੇਰਕੋਟਲਾ ਸੰਗਰੂਰ ਮੁਕਤਸਰ ਸਾਹਿਬ ਫ਼ਰੀਦਕੋਟ

ਸਮਰਾਲਾ ਮਾਛੀਵਾੜਾ ਖੰਨਾ ਧੰਨਵਾਦ ਜੀ